ਮੇਰੇ ਘਰ ਵਿੱਚ ਇੱਕ ਬਾਗ ਹੈ ਜਿਸ ਨੂੰ ਸਜਾਉਣਾ ਮੈਨੂੰ ਬੜਾ ਚੰਗਾ ਲੱਗਦਾ ਹੈ ਮੈਂ ਬਾਗ ਵਿੱਚ ਕਈ ਤਰ੍ਹਾਂ ਦੇ ਪੌਦੇ ਅਤੇ ਬੂਟੇ ਲਗਾਉਂਦੀ ਹਾਂ ਮੇਰੇ ਬਾਗ ਵਿੱਚ ਕਈ ਫੁੱਲਾਂ ਦੇ ਪੌਦੇ ਹਨ ਜੋ ਕਿ ਬਹੁਤ ਰੰਗੀਨ ਫੁੱਲ ਹਨ ਮੇਰੇ ਬਾਗ ਵਿੱਚ ਬਹੁਤ ਸਾਰੇ ਫ਼ਲਾਂ ਅਤੇ ਸਬਜ਼ੀਆਂ ਦੇ ਪੌਦੇ ਵੀ ਲੱਗੇ ਹੋਏ ਹਨ ਜੋ ਕਿ ਬਹੁਤ ਵੱਡੇ ਅਤੇ ਵਧੀਆ ਹਨ ਮੇਰੇ ਬਾਗ ਵਿੱਚ ਮੈਂ ਬਹੁਤ ਸਾਰੇ ਵਧੀਆ ਪੌਦੇ ਲਗਾਉਂਦੀ ਹਾਂ ਜੋ ਕਿ ਮੈਨੂੰ ਚੰਗੇ ਫ਼ਲ ਪ੍ਰਾਪਤ ਹੋਣ ਜਿਵੇਂ ਕਿ ਮੈਨੇ ਲਗਾਏ ਹੋਏ ਹਨ ਫੁੱਲਾਂ ਦੇ ਪੌਦੇ ਮੈਨੂੰ ਲਗਾਉਣੇ ਬਹੁਤ ਚੰਗੇ ਲੱਗਦੇ ਹਨ ਜੋ ਕਿ ਮੈਰੀਗੋਲਡ ਗੁਲਾਬ ਇਹ ਮੈਨੂੰ ਪੌਦੇ ਬਹੁਤ ਚੰਗੇ ਲੱਗਦੇ ਹਨ ਇਹਨਾਂ ਦੀ ਮੈਨੇ ਕਈ ਤਰ੍ਹਾਂ ਦੀਆਂ ਵਰਾਈਟੀਆਂ ਲਗਾਈਆਂ ਹੋਈਆ ਹਨ ਅਤੇ ਹੋਰ ਵੀ ਪੌਦੇ ਲਗਾਏ ਹੋਏ ਹਨ ਜਿਹਨਾਂ ਦੇ ਫੁੱਲ ਬਹੁਤ ਹੀ ਜ਼ਿਆਦਾ ਮੈਨੂੰ ਚੰਗੇ ਲੱਗਦੇ ਹਨ ਮੈਨੇ ਕਈ ਸਬਜ਼ੀਆਂ ਦੇ ਪੌਦੇ ਵੀ ਲਗਾਏ ਹਨ ਜਿਵੇਂ ਕਿ ਮਿਰਚਾਂ ਟਮਾਟਰ ਪਿਆਜ਼ ਆਦਿ ਇਹਨਾਂ ਸਾਰੇ ਪੌਦਿਆਂ ਦੀ ਮੈਂ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਦੀ ਹਾਂ ਮੈਨੇ ਕਈ ਫ਼ਲਾਂ ਦੇ ਪੌਦੇ ਵੀ ਲਗਾਏ ਹੋਏ ਹਨ ਜੋ ਕਿ ਬਾਰਾਂ ਮਹੀਨੇ ਤੀਹ ਦਿਨ ਉਹਨਾਂ ਉੱਤੇ ਫ਼ਲ ਰਹਿੰਦਾ ਹੈ ਇਹ ਪੌਦੇ ਬਹੁਤ ਚੰਗੇ ਲੱਗਦੇ ਹਨ ਅਤੇ ਮੈਂ ਇਹਨਾਂ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਦੀ ਹਾਂ ਮੈਂ ਮੌਸਮ ਅਨੁਸਾਰ ਵੀ ਆਪਣੇ ਪੌਦਿਆਂ ਨੂੰ ਬਦਲਦੀ ਰਹਿੰਦੀ ਹਾਂ ਜਦੋਂ ਗਰਮੀਆਂ ਦਾ ਮੌਸਮ ਆਉਂਦਾ ਹੈ ਤਾਂ ਮੈਂ ਹੋਰ ਪੌਦੇ ਲਗਾਉਂਦੀ ਹਾਂ ਅਤੇ ਗਰਮੀਆਂ ਦਾ ਮੌਸਮ ਜਦੋਂ ਆਉਂਦਾ ਹੈ ਤਾਂ ਮੈਂ ਹੋਰ ਪੌਦੇ ਲਗਾਉਂਦੀ ਹਾਂ ਅਤੇ ਸਰਦੀਆਂ ਵਿੱਚ ਹੋਰ ਪੌਦੇ ਲਗਾਉਂਦੀ ਹਾਂ ਤਾਂ ਕਿ ਮੌਸਮ ਅਨੁਸਾਰ ਮੇਰੇ ਪੌਦਿਆਂ ਉੱਤੇ ਫੁੱਲ ਰਵੇ ਅਤੇ ਫ਼ਲ ਰਵੇ ਮੈਂ ਜ਼ਿਆਦਾਤਰ ਪੌਦੇ ਫਰਵਰੀ ਵਿੱਚ ਉੱਗਦੇ ਹਨ ਇਸ ਕਾਰਨ ਮੈਂ ਫਰਵਰੀ ਵਿੱਚ ਜ਼ਿਆਦਾਤਰ ਫੁੱਲਾਂ ਦੇ ਪੌਦੇ ਲਗਾਉਂਦੀ ਹਾਂ ਆਪਣੇ ਬਾਗ ਜਿਸ ਕਾਰਨ ਮੇਰੇ ਬਾਗ ਦੀ ਸੁੰਦਰਤਾ ਬਣੀ ਰਹਿੰਦੀ ਹੈ ਅਤੇ ਮੇਰਾ ਬਾਗ ਹਰ ਟਾਇਮ ਚੰਗਾ ਦਿਖਾਈ ਦਿੰਦਾ ਹੈ ਜਿਸ ਨਾਲ ਮੇਰੇ ਦਿਲ ਨੂੰ ਵੀ ਚੰਗਾ ਲੱਗਦਾ ਹੈ